ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਜ਼ਿਆਦਾ ਫੈਸਲੇ ਲਏ ਨੇ ਪਰਮਾਤਮਾ ਨੂੰ ਆਪਣੇ ਕੋਲ ਹਾਜ਼ਰ ਨਾਜ਼ਰ ਮੰਨ ਕੇ ਜਿਸ ਤਰ੍ਹਾਂ ਮੈਂ ਆਪਣੇ ਘਰ ਬਣਾਇਆ ਉਹਦੇ ਵਿੱਚ ਵੀ ਮੈਂ ਪਰਮਾਤਮਾ ਦਾ ਹੀ ਉਹ ਕਰਿਆ ਵੀ ਪਰਮਾਤਮਾ ਜਿਸ ਤਰ੍ਹਾਂ ਤੁਸੀਂ ਕਰੋਗੇ ਉਸ ਤਰ੍ਹਾਂ ਪਰਮਾਤਮਾ ਮਤਲਬ ਅਸੀਂ ਮੰਨਦੇ ਹਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਆ ਜਿਹੜੀ ਉਹਨੂੰ ਸਹੀ ਰਾਹ 'ਤੇ ਚਲਾਉਣ ਲਈ ਉਹ ਫੈਸਲਾ ਲਿਆ ਮੈਂ ਆਪਣੇ ਬੱਚਿਆਂ ਨੂੰ ਮਤਲਬ ਬਾਹਰ ਜਾਣ ਤੋਂ ਰੋਕਿਆ ਵੀ ਆਪਾਂ ਬਾਹਰ ਫੋਰਨ 'ਚ ਨਹੀਂ ਜਾਣਾ ਆਪਾਂ ਇੱਥੇ ਰਹਿ ਕੇ ਹੀ ਪੰਜਾਬ ਦੇ ਵਿੱਚ ਵਧੀਆ ਕਾਰੋਬਾਰ ਕਰਨਾ ਬਹੁਤ ਤਰ੍ਹਾਂ ਦੇ ਜ਼ਿੰਦਗੀ ਦੇ ਵਿੱਚ ਉਲਝਣਾਂ ਆਈਆਂ ਜਿਹੜੀਆਂ ਮੈਂ ਆਪਣੇ ਮਤਲਬ ਫੈਸਲੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਸ ਦੀ ਸਲਾਹ ਲੈ ਕੇ ਹੀ ਪਰਮਾਤਮਾ ਦੀ ਮਤਲਬ ਲਏ ਨੇ ਬਹੁਤ ਔਕੜਾਂ ਆਈਆਂ ਨੇ ਜ਼ਿੰਦਗੀ ਦੇ ਵਿੱਚ ਜਿਹੜੇ ਫੈਸਲੇ ਲਏ ਨੇ ਮਤਲਬ ਪਰਮਾਤਮਾ ਨੇ ਬਹੁਤ ਸਾਥ ਦਿੱਤਾ ਮੇਰਾ